ਮੇਰੀ ਰਸੋਈ ਵਿੱਚ ਓਵਨ ਮਿਕਸਰ ਗਰੈਂਡਰ ਫਰਿੱਜ ਚਿਮਨੀ ਚਿਮਨੀ ਹੈ ਜਿਹਦੇ ਵਿੱਚ ਇਹ ਯੂਜ ਕਰਨ ਦੇ ਨਾਲ ਬਹੁਤ ਸਹਾਇਤਾ ਮਿਲਦੀ ਹੈ ਪਿਛਲੇ ਜ਼ਮਾਨੇ ਵਿੱਚ ਟਾਈਮ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ ਮੁਸ਼ਕਿਲ ਹੁੰਦੀ ਸੀਗੀ ਧੰਨ